ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਆਰਤੀ ਹੈ ਸਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਐ ਕਿ ਮੈਨੂੰ ਕੱਪੜੇ ਸਿਊਣਾ ਬਹੁਤ ਪਸੰਦ ਹੈ ਮੇਰੀ ਇੱਕ ਛੋਟੀ ਜਿਹੀ ਬੂਟੀਕ ਹੈ ਢੇਸੂਆਂ ਪਿੰਡ ਵਿੱਚ ਮੈਂ ਦੂਸਰਿਆਂ ਦੇ ਕੱਪੜੇ ਸਿਊਣਾ ਬਹੁਤ ਪਸੰਦ ਕਰਦੀ ਐਂ ਕਿਉਂਕਿ ਮੈਨੂੰ ਨਾ ਪਲਾਜੋ ਸੂਟ ਸਲਵਾਰ ਸੂਟ ਸਿਊਣਾ ਬਹੁਤ ਜ਼ਿਆਦਾ ਪਸੰਦ ਹੈ ਇਸ ਕਰਕੇ ਮੇਰੇ ਮੇਰੇ ਗਾਹਕ ਮੇਰੇ ਕੋਲੋਂ ਜ਼ਿਆਦਾ ਤੋਂ ਜ਼ਿਆਦਾ ਪਲਾਜੋ ਸੂਟ ਸਲਵਾਰ ਸੂਟ ਬਣਵਾਉਣਾ ਚਾਹੁੰਦੇ ਹੈ ਇਸ ਕਰਕੇ ਮੈਨੂੰ ਪਲਾਜੋ ਸੂਟ ਬਹੁਤ ਜ਼ਿਆਦਾ ਪਸੰਦ ਹੈ ਸਿਊਣਾ ਵੀ ਪਸੰਦ ਹੈ ਦਿਵਾਣਾ ਪਾਣਾ ਵੀ ਪਸੰਦ ਹੈ ਜਿਸ ਤਰੀਕ 'ਤੇ ਗਾਹਕ ਨੇ ਸੂਟ ਮੰਗਿਆ ਹੋਵੇ ਉਸ ਤਰੀਕ 'ਤੇ ਮੈਂ ਸੂਟ ਪੂਰੀ ਤਰ੍ਹਾਂ ਬਣਾ ਕੇ ਉਸਨੂੰ ਦਿੰਦੀ ਹਾਂ ਔਰ ਮੈਂ ਪਲਾਜੋ ਸੂਟ ਦੋ ਕੁ ਘੰਟੇ ਵਿੱਚ ਸੂਟ ਬਣ ਜਾਂਦਾ ਮੇਰਾ ਇਸ ਕਰਕੇ ਮੈਨੂੰ ਆ ਕੇ ਪੂਰੀ ਤਰ੍ਹਾਂ ਆਪਣੇ ਗਾਹਕ ਨੂੰ ਦੇ ਸਕਦੀ ਹਾਂ